ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਸ਼ਹਿਰਾਂ ਦੇ ਵਿੱਚ ਆਬਾਦੀ ਵੱਧ ਵੱਧ ਗਈ ਆ ਅਤੇ ਜਿਵੇਂ ਕੀ ਪਿੱਛੇ ਕਰੋਨਾ ਬਿਮਾਰੀ ਫੈਲੀ ਸੀ ਪੇਂਡੂ ਇੱਕ ਖੁੱਲ ਅਤੇ ਸਾਫ ਸੁਥਰਾ ਵਾਤਾਵਰਨ ਹੋਣ ਕਰਕੇ ਕਿਉਂਕਿ ਸਾਰਾ ਹੀ ਬਿਮਾਰੀ ਸੀਗੀ ਅਤੇ ਪਿੰਡਾਂ ਦਾ ਜਿਹੜਾ ਸਾਫ ਵਾਤਾਵਰਨ ਹੋਣ ਕਰਕੇ ਵੀ ਇੱਥੇ ਬਿਮਾਰੀ ਜਿਹੜੀ ਆ ਉਹ ਜ਼ਿਆਦਾਤਰ ਨਹੀਂ ਫੈਲ ਸਕੀ ਇਹਦਾ ਜ਼ਿਆਦਾ ਸ਼ਹਿਰਾਂ ਦੇ ਵਿੱਚ ਹੀ ਸੀ ਜਗ੍ਹਾ ਘੱਟ ਹੋਣ ਕਰਕੇ ਸ਼ਹਿਰੀ ਏਰੀਏ ਦੇ ਵਿੱਚ ਭੀੜ ਭੜੱਕਾ ਹੋਣ ਕਰਕੇ ਇਹ ਬਿਮਾਰੀ ਵੱਧ ਫੈਲੀ ਸੀ ਅਤੇ ਇਹ ਇਹਦੇ ਬਾਰੇ ਜਿਵੇਂ ਸਰਕਾਰ ਨੇ ਇੱਕ ਵਧੀਆ ਤਰੀਕੇ ਨਾਲ ਗਾਈਡੈਂਸ ਦਿੱਤੀ ਸੀ ਉਹਦੇ ਹਿਸਾਬ ਨਾਲ ਲੋਕਾਂ ਨੂੰ ਉਸ ਸਰਕਾਰ ਨੂੰ ਗੱਲਾਂ ਨੂੰ ਧਿਆਨ ਹਿੱਤ 'ਚ ਰੱਖ ਕੇ ਸਾਵਧਾਨੀਆਂ ਵਰਤੀਆਂ ਸੀ ਅਤੇ ਸ਼ਹਿਰਾਂ ਦਾ ਇੱਕ ਖਾਣ ਪੀਣ ਜੋ ਕਿ ਬਹੁਤ ਵਿਗੜ ਗਿਆ ਜਿਵੇਂ ਕਿ ਉਹ ਫਾਸਟ ਫੂਡ ਜ਼ਿਆਦਾ ਖਾਂਦੇ ਤਲੀਆਂ ਚੀਜ਼ਾਂ ਜਿਹਦੇ ਕਾਰਨ ਉਨ੍ਹਾਂ ਨੂੰ ਕਿਡਨੀ ਲੀਵਰ ਦੀ ਸਮੱਸਿਆ ਹੋ ਰਹੀ ਹੈ ਜ਼ਿਆਦਾਤਰ ਅਤੇ ਟਾਈਫਾਇਡ ਬੁਖਾਰ ਆਦਿ ਅਤੇ ਪਿੰਡਾਂ ਦੇ ਵਿੱਚ ਸ਼ੂਗਰ ਵਗੈਰਾ ਜਿਵੇਂ ਕਿ ਸ਼ ਇਹ ਤਾਂ ਬਿਮਾਰੀ ਸ਼ਹਿਰਾਂ 'ਚ ਵੀ ਹੈ ਪਿੰਡਾਂ 'ਚ ਵੀ ਐ ਸ਼ੂਗਰ ਵਗੈਰਾ ਅਤੇ ਉਹਦਾ ਖਾਣ ਪਾਣ ਉਹਦਾ ਵੀ ਧਿਆਨ ਹਣਾ ਅਜੇ ਰੱਖਣਾ ਚਾਹੀਦਾ ਅਤੇ ਬਾਕੀ ਬਿਮਾਰੀਆਂ ਜਿਹੜੀਆਂ ਵੀ ਜਿਵੇਂ ਟਾਈਫਾਇਡ ਡੇਂਗੂ ਮਲੇਰੀਆ ਇਹਦੇ ਤੋਂ ਆਪਾਂ ਨੂੰ ਬਚਣ ਵਾਸਤੇ ਅਤੇ ਇਹਨਾਂ ਤੋਂ ਆਪਾਂ ਨੂੰ ਏਰੀਏ ਦਾ ਵਾਤਾਵਰਨ ਆਪਣਾ ਸਾਫ ਘਰਾਂ 'ਚ ਸਫਾਈਆਂ ਖਾਸ ਖਿਆਲ ਸਫਾਈ ਦਾ ਰੱਖਣਾ ਚਾਹੀਦਾ ਅਤੇ ਆਪਣਾ ਖਾਣ ਪੀਣ ਦਾ ਖਾਸ ਖਿਆਲ ਰੱਖਣਾ ਚਾਹੀਦਾ ਅਤੇ ਸਮੇਂ ਸਮੇਂ 'ਤੇ ਆਪਣੇ ਸਰੀਰ ਦੀ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ ਸੋ ਇਹੋ ਹੀ ਹੈ ਕਿ ਸਾਡੇ ਜਿਹੜੇ ਸੁਝਾ ਆ ਕਿ ਸਾਨੂੰ ਹਰ ਇੱਕ ਡਾਕਟਰ ਦੀ ਡਾਕਟਰਾਂ ਦੇ ਅਨੁਸਾਰ ਹੀ ਚੱਲਣਾ ਚਾਹੀਦਾ